ਪੰਜਾਬੀ ਭਾਸ਼ਾ ਪੰਜਾਬ ਦੀ ਭਾਸ਼ਾ ਹੈ ਜਿਸਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੋਧਿਤ ਲੋਕ ਬੋਲਦੇ ਹਨ ਇਹ ਭਾਸ਼ਾਵਾਂ ਹਿੰਦੀ ਅਤੇ ਅੰਗਰੇਜ਼ੀ ਪਰਿਵਾਰਾਂ ਵਿੱਚੋਂ ਹਿੰਦ ਅੰਗਰੇਜ਼ੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਹੈ ਗੁਰਮੁਖੀ ਲਿੱਪੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ ਇਹ ਦੁਨੀਆਂ ਅਤੇ ਖ਼ਾਸਕਰ ਦੱਖਣੀ ਏਸ਼ੀਆ ਦੇ ਉੱਗੇ ਭੰਗੜਾ ਸੰਗੀਤ ਦੀ ਭਾਸ਼ਾ ਹੈ ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣੀ ਵਾਲੀ ਭਾਸ਼ਾ ਹੈ ਇਸ ਤੋਂ ਬਿਨ੍ਹਾਂ ਸ਼ਬਦ ਪੰਜਾਬੀ ਨੂੰ ਪੰਜਾਬ ਨਾਲ ਸੰਬੰਧਿਤ ਕਿਸੇ ਵੀ ਚੀਜ਼ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖੇਤਰ ਦੇ ਰਹਿਣ ਵਾਲਿਆਂ ਨੂੰ ਪੰਜਾਬੀ ਕਿਹਾ ਜਾਂਦਾ ਹੈ ਪੰਜਾਬੀ ਉੱਤਰ ਪੱਛਮੀ ਹਿੰਦ ਈਰਾਈਆਂ ਦੀ ਭਾਸ਼ਾ ਹੈ ਇਸ ਦੀਆਂ ਪੂਰਬੀਆਂ ਉਪ ਬੋਲੀਆਂ ਹਿੰਦੀ ਦੇ ਵਧੇਰੇ ਨੇੜੇ ਹਨ ਜਦਕਿ ਪੱਛਮੀ ਅਤੇ ਉੱਤਰ ਉਪ ਬੋਲੀਆਂ ਸਿੰਧੀ ਅਤੇ ਦਾਦਰੀ ਬੋਲੀਆਂ ਦੇ ਨਾਲ ਮਿਲਦੀਆਂ ਹਨ ਜਿਵੇਂ ਸੰਸਕ੍ਰਿਤ ਦਾ ਵ ਹਿੰਦੀ ਦੇ ਹਿੰਦੀ ਵਿੱਚ ਬੱਬਾ ਵਿੱਚ ਬਦਲ ਜਾਂਦਾ ਹੈ ਪੰਜਾਬੀ ਨੇ ਅਜੇ ਵੀ ਕੁਝ ਹਾਲਤਾਂ ਵਿੱਚ ਵਵੇ ਨੂੰ ਸੰਭਾਲ ਕੇ ਰੱਖਿਆ ਹੈ ਜਿਵੇਂ ਹਿੰਦੀ ਦਾ ਬੀਚ ਪੰਜਾਬੀ ਵਿੱਚ ਵਿੱਚ ਹੁੰਦਾ ਹੈ ਪੰਜਾਬੀ ਦੀਆਂ ਕੁਛ ਪੂਰਬੀ ਉਪ ਬੋਲੀਆਂ ਵਾਵਾ ਨੂੰ ਬੱਬੇ ਵਿੱਚ ਬਦਲ ਦਿੰਦੀਆਂ ਹਨ ਜਿਵੇਂ ਕਿ ਬਿੱਚ ਇਸ ਤੋਂ ਬਿਨ੍ਹਾਂ ਪ੍ਰਕਿਰਤੀ ਦੇ ਅਧੂਰੇ ਵਿਅੰਜਨ ਜਿਨ੍ਹਾਂ ਨੂੰ ਹਿੰਦੀ ਅਤੇ ਹੋਰ ਹਿੰਦ ਈਰਾਈਆਂ ਭਾਸ਼ਾਵਾਂ ਦੇ ਦ੍ਰੀਏ ਸੁਰ ਲਗਾ ਕੇ ਸੌਖਾ ਕਰ ਲਿਆ ਹੈ ਪੰਜਾਬੀਆਂ ਨੇ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ